ਹੈਲੋ ਤੁਸੀਂ ਭਰਾਵਾਂ ਦੇ ਢਾਬੇ ਤੋਂ ਬੋਲ ਰਹੇ ਹੋ ਉਹ ਮੈਂ ਦਰਅਸਲ ਇੱਕ ਪਾਰਟੀ ਔਰਗਨਾਇਸ ਕੀਤੀ ਆ ਜਿਹਦੇ ਲਈ ਮੈਨੂ ਕੁਛ ਓਡਰ ਚਾਹੀਦਾ ਹੈ ਤੁਹਾਡੇ ਸ਼ੋਪ ਤੋਂ ਮੈਨੂੰ ਕੁਛ ਸਨੈਕਸ ਅਤੇ ਮੇਨ ਕੋਰਸ ਚਾਹੀਦਾ ਹੈ ਸਨੈਕਸ ਦੇ ਵਿੱਚ ਤੁਸੀਂ ਬਰੈਡ ਪਕੌੜਾ ਕਰ ਦਿਉ ਅਤੇ ਕੁਛ ਦੂਸਰੇ ਗੋਬੀ ਵਾਲੇ ਪਕੌੜੇ ਕਰ ਦਿਉ ਅਤੇ ਮੇਨ ਕੋਰਸ ਦੇ ਵਿੱਚ ਦਾਲ ਮੱਖਣੀ ਅਤੇ ਮਿਕਸ ਵੈੱਜ ਕਰ ਦਿਉ ਅਤੇ ਉਸ ਦੇ ਨਾਲ ਹੀ ਕੁਛ ਕੋਲਡ ਡਰਿੰਕਸ ਅਤੇ ਕੌਫ਼ੀ ਵੀ ਅਤੇ ਨਾਲ ਕੁਛ ਨਾਨ ਕਰ ਦਿਓ ਤੁਸੀਂ ਇੰਨਾ ਸਭ ਦਾ ਕੀ ਪਰ ਪਲੇਟ ਕਿੰਨਾ ਰੇਟ ਲਓਗੇ ਪੰਜ ਸੌ ਨਹੀਂ ਨਹੀਂ ਇਹ ਬਹੁਤ ਜ਼ਿਆਦਾ ਹੈ ਮੈਂ ਪੰਜ ਸੌ ਨਹੀਂ ਦ ਦੇਣਾ ਨਹੀਂ ਚਾਰ ਸੌ ਵੀ ਨਹੀਂ ਇਹ ਇਹ ਵੀ ਜ਼ਿਆਦਾ ਹੈ ਚਲੋ ਸਾਡੇ ਤਿੰਨ ਸੌ ਠੀਕ ਨੇ ਨਹੀਂ ਚਲੋ ਠੀਕ ਆ ਫਿਰ ਚਾਰ ਸੌ ਠੀਕ ਹੈ ਚਾਰ ਸੌ ਠੀਕ ਹੈ ਤੁਸੀਂ ਫਿਰ ਕੱਲ੍ਹ ਕੱਲ੍ਹ ਕੱਲ੍ਹ ਛੇ ਤਰੀਕ ਨੂੰ ਛੇ ਤਰੀਕ ਨੂੰ ਅਡਰੈੱਸ ਮਕਾਨ ਨੰਬਰ ਚਾਲੀ ਨਿਅਰ ਯੂਨੀਵਰਸਿਟੀ ਪਹੁੰਚਾ ਦਿਓ